ਛੇ ਅਕਤੂਬਰ ਉੱਨੀ ਸੌੌੌੌ ਨੱਬੇ ਛੱਬੀ ਨਵੰਬਰ ਉੱਨੀ ਸੌ ਛਿਆਨਵੇਂ ਚਾਰ ਮਈ ਉੱਨੀ ਸੌ ਉਨਾਹਠ ਤੇਰਾਂ ਮਾਰਚ ਅਠਾਰਾਂ ਸੌ ਇਕਹੱਤਰ ਤੀਹ ਜੂ ਜੂਨ ਸਤਾਰਾਂ ਛਿਆਨਵੇਂ